ਪੰਜਾਬ ਇੱਕ ਹਿੰਦੁਸਤਾਨ ਦਾ ਬਹੁਤ ਹੀ ਪੁਰਾਣਾ ਰਾਜ ਹੈ ਇਸ ਜਗ੍ਹਾ 'ਤੇ ਬਹੁਤ ਹੀ ਜ਼ਿਆਦਾ ਕਾਰੋਬਾਰ ਕਰਨ ਦੇ ਮੌਕੇ ਹਨ ਟੂਰਿਜ਼ਮ ਉਸ ਦੇ ਵਿੱਚ ਇੱਕ ਬਹੁਤ ਹੀ ਵੱਡਾ ਕਾਰੋਬਾਰ ਕਰਨ ਦਾ ਇੱਕ ਰੋਜ਼ਗਾਰ ਦੇਣ ਦਾ ਇੱਕ ਜ਼ਰੀਆ ਹੈ ਪੰਜਾਬ ਦੀ ਧਾਰਮਿਕ ਰਾਜਧਾਨੀ ਕਿਹੇ ਜਾਣ ਵਾਲੇ ਅੰਮ੍ਰਿਤਸਰ ਸਾਹਿਬ ਨੂੰ ਇੱਕ ਬਹੁਤ ਹੀ ਵੱਡਾ ਟੂਰਿਸਟ ਦੇ ਆਗਮਨ ਦਾ ਸ਼ਹਿਰ ਕਿਹਾ ਜਾਂਦਾ ਹੈ ਇੱਕ ਬਹੁਤ ਇੱਕ ਡਾਟਾ ਦੇ ਅਨੁਸਾਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੋਜ਼ ਦੇ ਕਈ ਲੱਖਾਂ ਟੂਰਿਸਟ ਦੇਸ਼ ਵਿਦੇਸ਼ ਦੇ ਵਿੱਚੋਂ ਆਉਂਦੇ ਹਨ ਇਸ ਜਗ੍ਹਾ ਦੀ ਆਪਣੀ ਹੀ ਇੱਕ ਮਹਾਨਤਾ ਹੈ ਜੋ ਕਿ ਇੱਕ ਟੂਰਿਜਮ ਦੇ ਤੌਰ 'ਤੇ ਲੋਕਾਂ ਦੇ ਰੋਜ਼ਗਾਰ ਨੂੰ ਚਲਾਉਣ ਦੇ ਵਿੱਚ ਬਹੁਤ ਹੀ ਸਹਾਇਕ ਹੁੰਦਾ ਹੈ ਜੋ ਕਿ ਆਮ ਸ਼ਹਿਰ ਵਾਸੀਆਂ ਲਈ ਅਤੇ ਜਿਹੜੇ ਵੀ ਟੂਰਿਜ਼ਮ ਦੇ ਨਾਲ ਜੁੜੇ ਹੋਏ ਬੰਦੇ ਹਨ ਉਤੇ ਹੋਟਲ ਵਾਲਿਆਂ ਲਈ ਇੱਕ ਬਹੁਤ ਹੀ ਵੱਡਾ ਰੁਜ਼ਗਾਰ ਦਾ ਤਰੀਕਾ ਕਿਹਾ ਜਾਂਦਾ ਹੈ ਟੂਰਿਜ਼ਮ ਤੋਂ ਬਹੁਤ ਹੀ ਜ਼ਿਆਦਾ ਲੋਕ ਪੈਸੇ ਕਮਾ ਰਹੇ ਹਨ ਅਤੇ ਆਪਣੇ ਦਿਨ ਚਰਿਆ ਦੇ ਵਿੱਚ ਜੋ ਵੀ ਉਹਨਾਂ ਦਾ ਆਉਣ ਵਾਲਾ ਖਰਚ ਹੈ ਇੱਕ ਟੂਰਿਜ਼ਮ ਤੋਂ ਉਹ ਪੂਰਾ ਕਰਦੇ ਹਨ ਧੰਨਵਾਦ